ਜਿਵੇਂ ਆਪਾਂ ਸਾਰਿਆਂ ਨੂੰ ਪਤਾ ਹੀ ਆ ਕਿ ਆਪਾਂ ਕਿਸੇ ਵੀ ਚੀਜ਼ ਦਾ ਅਭਿਆਸ ਕਰਨ ਨਾਲ ਹੀ ਉਸ ਚੀਜ਼ 'ਤੇ ਪਕੜ ਬਣਾ ਸਕਦੇ ਹਾਂ ਜਿਵੇਂ ਹੁਣ ਕਿਸੇ ਵੀ ਵਿਅਕਤੀ ਨੇ ਗਾਉਣਾ ਹੈ ਤਾਂ ਆਪਾਂ ਜੇਕਰ ਉਸਦਾ ਅਭਿਆਸ ਪਹਿਲਾ ਹੀ ਸ਼ੁਰੂ ਕਰਾਂਗੇ ਤਾਂ ਫਿਰ ਹੀ ਉਸਨੂੰ 'ਚ ਹੌਲੀ ਹੌਲੀ ਨਿਖਾਰ ਆਊਗਾ ਅਤੇ ਫਿਰ ਹੀ ਆਪਾਂ ਚੰਗੇ ਕਲਾਕਾਰ ਬਣ ਸਕਦੇ ਹਾਂ ਜੇ ਆਪਾਂ ਮਿਹਨਤ ਹੀ ਨਾ ਕਰਾਂਗੇ ਮਤਲਬ ਸ ਹਰਮੋਨੀਅਮ 'ਤੇ ਮਿਹਨਤ ਨਾ ਕਰਾਂਗੇ ਸਾਰੇ ਕੰਮ ਨਾ ਸਿੱਖਾਂਗੇ ਤਾਂ ਫਿਰ ਅਸੀਂ ਵਧੀਆ ਗਾ ਨਹੀਂ ਸਕਦੇ ਗਾ ਤਾਂ ਲਵਾਂਗੇ ਪਰ ਵਧੀਆ ਨਹੀਂ ਗਾ ਸਕਦੇ ਗੇ ਜਿਵੇਂ ਹੁਣ ਆਪਾਂ ਆਪਣੇ ਹੁਨਰ ਨੂੰ ਸੁਧਾਰਨਾ ਹੈ ਤਾਂ ਗਾਉਣਾ ਤਾਂ ਜ਼ਰੂਰੀ ਆ ਅਤੇ ਰਿਆਜ਼ ਵੀ ਜ਼ਰੂਰੀ ਆ ਜੇ ਆਪਾਂ ਰਿਆਜ਼ ਕਰਾਂਗੇ ਤੇ ਤਾਂ ਹੀ ਆਪਣੇ ਹੁਨਰ 'ਚ ਨਿਖਾਰ ਆਊਗਾ ਰਿਆਜ਼ ਸਾਨੂੰ ਘੱਟ ਤੋਂ ਘੱਟ ਦੋ ਤੋਂ ਤਿੰਨ ਘੰਟੇ ਤਾਂ ਜ਼ਰੂਰ ਕਰਨਾ ਚਾਹੀਦਾ ਵਾ ਕਿਉਂਕਿ ਸਵੇਰ ਤੋਂ ਲੈ ਕੇ ਮਤਲਬ ਚਾਰ ਵਜੇ ਤੋਂ ਲੈ ਕੇ ਸੱਤ ਵਜੇ ਤੱਕ ਰਿਆਜ਼ ਜਰੂਰ ਕਰਨਾ ਚਾਹੀਦਾ ਵਾ ਕਿਉਂਕਿ ਉਸ ਟਾਈਮ ਸਾਰੇ ਪਾਸੇ ਸ਼ਾਂਤੀ ਹੁੰਦੀ ਆ ਅਤੇ ਕਿਸੇ ਵੀ ਚੀਜ਼ ਦਾ ਸ਼ੋਰ ਨਹੀਂ ਹੁੰਦਾ ਗਾ ਅਤੇ ਵਧੀਆ ਹਵਾ ਸ਼ੁੱਧ ਹੁੰਦੀ ਆ ਜਿਹਨ ਦੇ ਨਾਲ ਆਪਣੀ ਆਪਾਂ ਨੂੰ ਗਾਉਣ ਦਾ ਵੀ ਮਤਲਬ ਖੁਸ਼ੀ ਮਿਲਦੀ ਆ ਗਾ ਕੇ ਵੀ ਅਤੇ ਸਾਡਾ ਸਰੀਰ ਵੀ ਨਾ ਕੰਫਰਟੇਬਲ ਤੰਦਰੁਸਤ ਮਹਿਸੂਸ ਕਰਦਾ ਵਾ ਜੇਕਰ ਅਸੀਂ ਗਾਉਣ ਦੇ ਨਾਲ ਨਾਲ ਹਾਰਮੋਨੀਅਮ ਦੀ ਮਦਦ ਲਵਾਂਗੇ ਤਾਂ ਸਾਨੂੰ ਮਤਲਬ ਬਹੁਤ ਵਧੀਆ ਲੱਗੇਗਾ ਸਾਨੂੰ ਇੱਦਾਂ ਲੱਗੇਗਾ ਜਿਵੇਂ ਅਸੀਂ ਬਹੁਤ ਹੀ ਵਧੀਆ ਗਾ ਰਹੇ ਹਾਂ ਸਵੇਰ ਦੇ ਸਮੇਂ ਵਿੱਚ ਅਸੀਂ ਬਹੁਤ ਵਧੀਆ ਗਾ ਸਕਦੇ ਹਾਂ ਬਹੁਤ ਵਧੀਆ ਸੁਣ ਕੇ ਫਿਰ ਹੀ ਬਹੁਤ ਵਧੀਆ ਗਾ ਸਕਦੇ ਹਾਂ ਜੇ ਆਪਾਂ ਮਾੜਾ ਸੁਣਾਂਗੇ ਤਾਂ ਮਾੜਾ ਹੀ ਗਾਵਾਂਗੇ ਜੇ ਆਪਾਂ ਵਧੀਆ ਸੁਣਾਂਗੇ ਜਿਵੇਂ ਗਜ਼ਲ ਹੋ ਗਏ ਕਵਾਲੀਆਂ ਹੋ ਗਈਆਂ ਇੱਦਾਂ ਦੀਆਂ ਚੀਜ਼ਾਂ ਸੁਣਾਂਗੇ ਤਾਂ ਬਹੁਤ ਵਧੀਆ ਗਾ ਸਕਦੇ ਹਾਂ ਸੋ ਵਧੀਆ ਸੁਣਨਾ ਚਾਹੀਦਾ ਅਤੇ ਵਧੀਆ ਗਾਉਣਾ ਚਾਹੀਦਾ ਧੰਨਵਾਦ